ਵਪਾਰਕ ਖੇਤਰ ਸਾਡੇ ਜੀਵਨ ਨੂੰ ਉੱਚਾ ਚੁੱਕਣ ਵਿੱਚ ਕਾਫ਼ੀ ਯੋਗਦਾਨ ਪਾਉਂਦੇ ਹਨ ਪੰਜਾਬ ਵਿੱਚ ਵਪਾਰਕ ਖੇਤਰ ਵਿਕਾਸ ਵਿੱਚ ਯੋਗਦਾਨ ਇੰਨਾ ਵਧੀਆ ਪਾ ਰਹੇ ਹਨ ਤਾਂ ਜੋ ਹਰੇਕ ਬੰਦੇ ਦਾ ਵਪਾਰ ਵਿੱਚ ਕਰਨ ਨੂੰ ਮਨ ਬਣਿਆ ਰਹੇ ਪੰਜਾਬ ਦੇ ਸਮਾਜਿਕ ਉਦਯੋਗਿਕ ਸੱਭਿਆਚਾਰਕ ਅਤੇ ਆਰਥਿਕ ਵਿਕਾਸ ਵਿੱਚ ਖੇਤੀਬਾੜੀ ਇੱਕ ਅਹਿਮ ਯੋਗਦਾਨ ਪਾ ਰਹੀ ਹੈ ਸੂਬੇ ਦੀ ਪੈਂਹਠ ਪ੍ਰਤੀਸ਼ਤ ਆਬਾਦੀ ਆਪਣੀ ਰੋਜ਼ੀ ਰੋਟੀ ਅਤੇ ਰੁਜ਼ਗਾਰ ਲਈ ਸਿੱਧੇ ਜਾਂ ਅਸਿੱਧੇ ਤੌਰ 'ਤੇ ਖੇਤੀਬਾੜੀ 'ਤੇ ਨਿਰਭਰ ਹੈਗੀ ਪੰਜਾਬ ਵਾਸੀਆਂ ਦੇ ਜੀਵਨ ਜਾਂਚ ਅਤੇ ਆਰਥਿਕਾਂ ਵਿੱਚ ਖੇਤੀਬਾੜੀ ਦੀ ਇੱਕ ਅਹਿਮ ਅਤੇ ਨਿਰਭਰ ਭੂਮਿਕਾ ਨਿਭਾਈ ਗਈ ਖੇਤੀਬਾੜੀ ਇਕ ਇਹੋ ਜਿਹਾ ਕਿੱਤਾ ਹੈ ਜਿਸ ਵਿੱਚ ਮੁਨਾਫੇ ਦੀ ਬਹੁਤ ਸਮਰੱਥਾ ਪਿੰਡ ਦੇ ਨੌਜਵਾਨਾਂ ਦੀ ਖੇਤੀ ਪ੍ਰਤੀ ਨਕਾਰਤਮਕ ਧਾਰਨਾ ਅਤੇ ਵਿਦੇਸ਼ਾਂ ਵੱਲ ਪਰਿਵਾਰ ਦੇ ਰੁਝਾਨ ਕਾਰਨ ਖੇਤੀ ਤੋਂ ਮੁਨਾਫੇ ਦੀ ਸਮਰਥਾ ਨੂੰ ਵਧਾਇਆ ਨਹੀਂ ਜਾ ਸਕਿਆ ਜਿਸ ਕਾਰਨ ਕਿਸਾਨ ਅਤੇ ਗੈਰ ਕਿਸਾਨ ਦੇ ਆਰਥਿਕ ਅਤੇ ਸਮਾਜਿਕ ਪੱਧਰ ਵਿੱਚ ਬਹੁਤ ਵੱਡਾ ਅੰਤਰ ਹੈ ਅੱਜ ਕੱਲ੍ਹ ਹਰੇਕ ਆਦਮੀ ਵਪਾਰ ਕਰਨ ਦੇ ਰਾਹ 'ਤੇ ਤੁਰਿਆ ਹੈ ਕਿਉਂਕਿ ਨਵੀਆਂ ਨੌਕਰੀਆਂ ਦੀ ਬਹੁਤ ਘਾਟ ਆ ਰਹੀ ਹੈ ਵਪਾਰ ਪੱਧਰ ਇੱਕ ਨਵਾਂ ਯੋਗਦਾਨ ਪਾ ਰਿਹਾ ਹੈ ਹਰੇਕ ਵਿਅਕਤੀ ਛੋਟੇ ਤੋਂ ਛੋਟਾ ਉਦਯੋਗ ਸ਼ੁਰੂ ਕਰਕੇ ਆਪਣੀ ਕਾਮਯਾਬੀ ਹਾਂਸਲ ਕਰਨਾ ਚਾਹੁੰਦਾ ਹੈ ਇੱਥੋਂ ਤੱਕ ਕਿ ਸਰਕਾਰ ਨੇ ਨਵਾਂ ਵਪਾਰ ਸ਼ੁਰੂ ਕਰਨ ਲਈ ਕਾਫ਼ੀ ਸਹੂਲਤਾਂ ਕੱਢੀਆਂ ਹਨ ਇੱਕ ਨਵਾਂ ਵਿਅਕਤੀ ਲੋਨ ਲੈ ਕੇ ਵੀ ਨਵਾਂ ਬਿਜ਼ਨਸ ਸ਼ੁਰੂ ਕਰ ਸਕਦਾ ਤਾਂ ਜੋ ਆਪਣਾ ਇੱਕ ਸੋਚਿਆ ਹੋਇਆ ਸਪਨਾ ਪੂਰਾ ਕਰ ਸਕੇ ਇਸ ਲਈ ਉਸ ਨੂੰ

ਨੌਕਰੀ ਨਾਲ ਵਪਾਰ ਨੂੰ ਜ਼ਿਆਦਾ ਮਹੱਤਤਾ ਦਿੱਤੀ ਗਈ ਹੈ ਕਿਉਂਕਿ ਜਿੱਥੇ ਉਹ ਆਪਣੇ ਲਈ ਕੰਮ ਕਰਦਾ ਹੈ ਉੱਥੇ ਹੋਰਾਂ ਲਈ ਵੀ ਰੁਜ਼ਗਾਰ ਦੇ ਮੌਕੇ ਪੈਦਾ ਕਰਦਾ ਹੈ ਇਸ ਨਾਲ ਵਪਾਰ ਕਰਨ ਨਾਲ ਜਿਹੜੀ ਦੇਸ਼ ਦੀ ਜੀ ਡੀ ਪੀ ਵਿੱਚ ਵਾਧਾ ਹੁੰਦਾ ਹੈ ਅਤੇ ਆਪਣੇ ਦੇਸ਼ ਦਾ ਜਿਹੜਾ ਨਾਮ ਹੈ ਉਹ ਰੋਸ਼ਨ ਹੁੰਦਾ ਹੈ ਇਹਦੇ ਨਾਲ ਕਰਨ ਨਾਲ ਦੇਸ਼ ਤਰੱਕੀ ਕਰਦਾ ਹੈ ਅਤੇ ਬਾਕੀ ਦੇਸ਼ਾਂ ਤੋਂ ਉੱਪਰ ਜਾਂਦਾ ਹੈ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਹੁੰਦਾ ਹੈ ਨਵੀਆਂ ਨਵੀਆਂ ਵਪਾਰ ਵਿੱਚ ਨਵੀਆਂ ਨਵੀਆਂ ਤਕਨੀਕਾਂ ਲੈ ਕੇ ਆਉਂਦੇ ਰਹਿਣ ਨਾਲ ਵਪਾਰ ਦੀ ਡਿਵੈਲਪਮੈਂਟ ਵਿੱਚ ਵਾਧਾ ਹੁੰਦਾ ਹੈ ਜਿਸ ਨਾਲ ਕੀਤੇ ਗਏ ਨਿਵੇਸ਼ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਸਾਰੇ ਨਿਵਾਸੀਆਂ ਨੂੰ ਵੀ ਫ਼ਾਇਦਾ ਮਿਲਦਾ ਹੈ ਅਤੇ ਭਾਰਤ ਵਾਸੀਆਂ ਦਾ ਇੱਕ ਰੁਝਾਨ ਵਪਾਰ ਉੱਤੇ ਬਣਿਆ ਹੋਇਆ ਹੈ ਜਿਸ ਨਾਲ ਅਸੀਂ ਵਪਾਰ ਕਰਨ ਵਿੱਚ ਵਾਧਾ ਕਰ ਰਹੇ ਹਾਂ